ਗੈਸ ਨੂੰ ਗੈਸ ਨੂੰ ਵਰਤਣ ਲਈ ਜਿਹੜਾ ਹੈ ਉਸ ਦਾ ਬੜਾ ਧਿਆਨ ਰੱਖਣਾ ਪੈਂਦਾ ਕਿਉਂਕਿ ਉਸ ਦੀ ਜਿਹੜੀ ਪਾਈਪ ਹੁੰਦੀ ਉਹਦਾ ਵੀ ਬੜਾ ਧਿਆਨ ਰੱਖਣਾ ਪੈਂਦਾ ਉਹਨੂੰ ਸਾਫ ਸੁਥਰਾ ਰੱਖਣਾ ਪੈਂਦਾ ਅਤੇ ਨੋਬ ਜਿਹੜੀ ਹੈ ਉਹਨੂੰ ਕਿ ਰਾਤੀਂ ਸੌਣ ਤੋਂ ਪਹਿਲਾਂ ਬੰਦ ਕਰਕੇ ਸੋ ਰੱਖਣਾ ਚਾਹੀਦਾ ਹੈ ਸਵੇਰੇ ਉੱਠ ਕੇ ਫਿਰ ਉਹ ਉਹਨੂੰ ਕਿ ਆਨ ਕਰ ਲੈਣਾ ਚਾਹੀਦਾ ਹੈ ਤਾਂ ਕਿ ਇਹ ਸਾਨੂੰ ਕੋਈ ਨੁਕਸਾਨ ਨਾ ਪਹੁੰਚਾਏ ਸਾਡੀ ਇਹ ਸਾਵਧਾਨੀ ਦਾ ਸਾਧਨ ਬਣੇ ਇਹ ਨਾ ਹੋਵੇ ਕਿ ਸਾਡੀ ਇਹ ਕਿ ਸਾਨੂੰ ਨੁਕਸਾਨ ਪਹੁੰਚਾਏ ਜਿਹੜਾ ਜਿਹੜਾ ਕਿ ਇਹ ਖਾਣਾ ਬਣਾਉਣਾ ਅਸੀਂ ਆਪਣਾ ਕਿ ਗੈਸ 'ਤੇ ਇਹ ਹੌਲੀ ਹੌਲੀ ਬਣੇ ਹੌਲੀ ਕਰ ਲਓ ਕਦੀ ਤੇਜ਼ ਕਰ ਲਓ ਹੌਲੀ ਹੌਲੀ ਬਣੇ ਅਤੇ ਜਿਹੜਾ ਕਿ ਇਹ ਗੈਸ ਜਿਹੜੀ ਵਰਤੋਂ ਘੱਟ ਵੱਧ ਹੁੰਦੀ ਰਵੇ ਅਤੇ ਇਹ ਜਿਹੜੀ ਗੈਸ ਹੈ ਗੈਸ ਨੂੰ ਅਸੀਂ ਚੈੱਕ ਕਰਦੇ ਸਾਨੂੰ ਇਹਨੂੰ ਲੋੜਵੰਦ ਲੋੜ ਵੇਲੇ ਸਹੀ ਅਤੇ ਸਹੀ ਟਾਈਮ 'ਤੇ ਇਹਨੂੰ ਚੈੱਕ ਕਰਦੇ ਰਹਿਣਾ ਚਾਹੀਦਾ ਤਾਂ ਕਿ ਇਸ ਦੀ ਸਾਨੂੰ ਜਿਹੜੀ ਵਰਤੋ ਹੈ ਉਹਨੂੰ ਸਹੀ ਤਰੀਕੇ ਨਾਲ ਕਰਨੀ ਆਉਣੀ ਚਾਹੀਦੀ ਹੈ ਚੈੱਕ ਕਰਦਿਆਂ ਕਰਦਿਆਂ ਸਾਨੂੰ ਪਤਾ ਲੱਗਦਾ ਹੈ ਕਿ ਇਸ ਨੂੰ ਅਸੀਂ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਨਾ ਅਤੇ ਇਹਦਾ ਧਿਆਨ ਰੱਖਿਆ ਜਾਂਦਾ ਹੈ ਇਸ ਲਈ ਫਿਰ ਆਪਾਂ ਇਸ ਦੀ ਵਰਤੋਂ ਸਹੀ ਤਰੀਕੇ ਨਾਲ ਕਰ ਸਕਦੇ ਹਾਂ ਅਤੇ ਆਪਣੇ ਬੱਚਿਆਂ ਨੂੰ ਵੀ ਅਸੀਂ ਦੱਸ ਸਕਦੇ ਹਾਂ ਤਾਂ ਕਿ ਆਪਣੇ ਇੱਦਾਂ ਕਰਨਾ ਤੁਸੀਂ ਇੱਦਾਂ ਕਰਨਾ ਹੈ ਅਤੇ ਫਿਰ ਬੱਚੇ ਵੀ ਉਸੇ ਤਰੀਕੇ ਨਾਲ ਹੀ ਉਹ ਕਰਦੇ ਹਨ ਜੇ ਸਾਨੂੰ ਹੀ ਨਹੀਂ ਪਤਾ ਹੋਏਗਾ ਤਾਂ ਬੱਚੇ ਕਿੱਦਾਂ ਕਰਨਗੇ ਇਸ ਕਰਕੇ ਬੱਚਿਆਂ ਨੂੰ ਸਾਰੀ ਇਹਦੀ ਸਾਰਾ ਸਮਝਾਉਣਾ ਕਿ ਇਸ ਨੂੰ ਸਾਫ ਸੁਥਰਾ ਕਰਨਾ ਇਹਦੀ ਪਾਈਪ ਨੂੰ ਚੈੱਕ ਕਰਨਾ ਇਹਦੀ ਰਾਤੀਂ ਇਹਦੀ ਨੋਬ ਬੰਦ ਕਰਕੇ ਸੋਣਾ ਕਿ ਸਵੇਰੇ ਫਿਰ ਉੱਠ ਕੇ ਇਹਨੂੰ ਔਨ ਕਰਨਾ ਹੈ ਅਤੇ ਔਨ ਕਰਕੇ ਅਤੇ ਫਿਰ ਅਸੀਂ ਵਧੀਆ ਜਿਹਾ ਅਸੀਂ ਕਰਨਾ ਹੈ ਧੰਨਵਾਦ